ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਅੱਛਾ ਅੱਛਾ ਸਾਹਿਲ ਜੀ ਬੋਲ ਰਹੇ ਹੋ ਹਾਂਜੀ ਹੋਰ ਭਾਅ ਜੀ ਠੀਕ ਠਾਕ ਹੋ ਭਾਅ ਜੀ ਦੇਖੋ ਖੇਤੀਬਾੜੀ ਤਾਂ ਅੱਛੀ ਚੱਲ ਰਹੀ ਹੈ ਭਾਅ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਇੱਥੇ ਦੀ ਜਿਹੜੀ ਮਿੱਟੀ ਹੈ ਪੂਰੀ ਉਪਜਾਊ ਹੈ ਐਨ ਮਤਲਬ ਅੱਛਾ ਲੱਗਦਾ ਕੰਮ ਕਰਦੇ ਵੇਲੇ ਵੀ ਪਰ ਇਹ ਹੈ ਹਾਂਜੀ ਹਾਂਜੀ ਭਾਅ ਜੀ ਤੁਸੀਂ ਸਹੀ ਕਹਿ ਰਹੇ ਹੋ ਉਹਦੇ ਨਾਲ ਹੀ ਅਸੀਂ ਜੋ ਖਾ ਪੀ ਰਹੇ ਉਹਦੇ ਨਾਲ ਹੀ ਹੈ ਭਾਅ ਜੀ ਜ ਜਿਆਦਾਤਰ ਜਿਹੜੇ ਅਸੀਂ ਆਪਣੇ ਉਂ ਜਿੱਦਾਂ ਤੁਸੀਂ ਸੋਚ ਲਉ ਮੰਨ ਕੇ ਚੱਲੋ ਵੀ ਜਿਹੜੇ ਅਸੀਂ ਚਾਵਲ ਖਾ ਰਹੇ ਨਾ ਆਪਣੇ ਘਰ ਬਹਿ ਕੇ ਉਹ ਅਸੀਂ ਆਪਣੇ ਖੁਦ ਦੇ ਉਗਾਏ ਖਾ ਰਹੇ ਭਾਅ ਜੀ ਇਸ ਟਾਈਮ ਆਪਾਂ ਉਹ ਚਾਵਲ ਉਹ ਚਾਵਲ ਹਾਂਜੀ ਮੈਂ ਉਹੀ ਕਹਿ ਰਿਹਾ ਚਾਵਲ ਅਸੀਂ ਮੁੱਲ ਨਹੀਂ ਲਏ ਕਿਸੇ ਤੋਂ ਉਹ ਆਪਣੇ ਚੌਲ ਖਾ ਰਹੇ ਭਾਅ ਜੀ ਆਪਾਂ ਹਾਂਜੀ ਹਾਂਜੀ ਹਾਂਜੀ ਭਾਅ ਜੀ ਉਪਜਾਊ ਤਾਂ ਹੈ ਹਾਂਜੀ ਹਾਂਜੀ ਭਾਜੀ ਤਰੱਕੀ ਤਾਂ ਭਾਜੀ ਦੇਖੋ ਪੰਜਾਬ 'ਚ ਇੱਕ ਹੀ ਹੈ ਕਿ ਖਾਣ ਪੀਣ 'ਚ ਜਿੱਦਾਂ ਮਤਲਬ ਜਿੱਦਾਂ ਅੱਛਾ ਹੈ ਇੱਧਰ ਸਾਡੇ ਪੰਜਾਬ 'ਚ ਬਾਕੀ ਨਾਲੋਂ ਕਿਉਂਕਿ ਇੱਥੇ ਫੂਡ ਦੀ ਜਿੱਦਾਂ ਕਿਉਂਕਿ ਜਿੱਦਾਂ ਖਾਣਾ ਨਾ ਇੱਧਰ ਦਾ ਇੱਥੋਂ ਹੀ ਜ ਮਤਲਬ ਜਨਰੇਟ ਹੋ ਰਿਹਾ ਸਾਡੇ ਇੱਧਰੋਂ ਹੀ ਆਹ ਜਿਹੜੇ ਚੌਲ ਹੋ ਗਏ ਆਟਾ ਹੋ ਗਏ ਗੰਨੇ ਹੋ ਗਏ ਗੰਨੇ ਹੋ ਗਏ ਕ ਕਿੰਨਾ ਕੁਝ ਹੋ ਗਿਆ ਇੱਧਰੋਂ ਹੀ ਆ ਰਿਹਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਆ ਭਾਅ ਜੀ ਓਕੇ ਜੀ ਧ ਧੰਨਵਾਦ ਜੀ ਧੰਨਵਾਦ ਓਕੇ